ਹੈਲੋ ਹਾਂਜੀ ਹਾਂਜੀ ਭਾਅ ਜੀ ਪੇਂਟ ਕੰਪਨੀ ਤੋਂ ਗੱਲ ਰਿਹਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਆਪਣੇ ਜਿਹੜੇ ਪੇਂਟ ਵਗੈਰਾ ਉਹ ਵਧੀਆ ਕੁਆਲਟੀ ਦਾ ਹੋਏਗਾ ਜੀ ਇੱਕ ਤਾਂ ਅਤੇ ਜਿਹੜੇ ਆਪਣੇ ਇਹਦੇ 'ਚ ਅਲੱਗ ਅਲੱਗ ਤਰ੍ਹਾਂ ਦੇ ਆਪਣੇ ਕਲਰ ਮਿਲਣਗੇ ਜੀ ਆਪਣੇ ਕਲਰਜ਼ ਕਾਫ਼ੀ ਕਲਰਜ਼ ਹੈ ਤੁਸੀਂ ਆਪਣੇ ਕਲਰ ਦੀ ਚੋਆਇਸ ਦੱਸ ਦਿਉ ਜੀ ਕਿਹੜੇ ਕਿਹੜੇ ਕਲਰ ਕਰਵਾਉਣੇ ਹੈ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਸੀਟਸ ਵਗੈਰਾ ਵੀ ਹੈ ਬਾਕੀ ਤੁਸੀਂ ਆਪਾਂ ਪੇਂਟ ਦੀ ਗੱਲ ਕਰ ਰਹੇ ਹਾਂ ਜੀ ਮੇਨ ਤਾਂ ਪੇਂਟ ਤੇ ਜਿਹੜਾ ਹੈ ਨਾ ਜੀ ਪੇਂਟ ਤੁਹਾਡੇ ਇੱਕ ਤੁਸੀਂ ਕਹਿ ਰਹੇ ਹੋ ਕਿ ਬੈੱਡਰੂਮ 'ਚ ਕਰਨਾ ਰੈੱਡ ਕਲਰ ਜੀ ਇੱਕ ਤਾਂ ਜੀ ਪੱਟੀ ਭਰੀ 'ਤੇ ਕਰੇਗਾ ਜੀ ਆਪਣੇ ਪੱਟੀ ਨਾਲ ਭਰੀਂਦਾ ਜੀ ਕਲਰ ਇੱਕ ਜੀ ਸਿੰਪਲ ਕਲਰ ਹੁੰਦਾ ਜੀ ਦੋ ਤਰ੍ਹਾਂ ਦੇ ਕਲਰ ਆਪਾਂ ਜੇ ਪੱਟੀ ਭਰਾ ਕੇ ਕਰਾਉਣਾ ਹੈ ਕਿ ਜੀ ਦੂਜੀ ਤਰ੍ਹਾਂ ਸਿੰਪਲ ਕਲਰ ਕਰਾਉਣਾ ਜੀ ਜਿਹਨੂੰ ਆਪਾਂ ਵਾਈਟ ਵਾਸ਼ ਸਿੰਪਲ ਕਹਿ ਦਿੰਦੇ ਹਾਂ ਜੀ ਹਾਂਜੀ ਉਹ ਦੋਨੋਂ ਕੰਮ ਹੋ ਜਾਣਗੇ ਜੀ ਆਪਣੇ ਵਿੱਚ ਹੀ ਪੇਂਟ ਵੀ ਹੋ ਜੂਗਾ ਪੱਟੀ ਵੀ ਭਰ ਦੇਣਗੇ ਜੀ ਆਪਣੇ

ਹਾਂਜੀ ਜੀ ਆਪਣੇ ਕੋਲ ਏਸ਼ੀਅਨ ਪੇਂਟਸ ਦੇ ਕਲਰ ਹੈਗੇ ਹੈ ਜੀ ਵਧੀਆ ਉਨ੍ਹਾਂ 'ਚ ਆਪਾਂ ਨੂੰ ਹਾਂਜੀ ਉਹਦੇ ਵਿੱਚ ਆਪਾਂ ਨੂੰ ਜੀ ਪੇਂਟਸ ਦੇ ਵਿੱਚ ਇੱਕ ਤਾਂ ਜੀ ਇੱਕ ਸਾਲ ਦਾ ਆਪਣੇ ਉਹ ਰਹਿੰਦਾ ਜੀ ਕਿ ਵਧੀਆ ਨਾ ਤਾਂ ਕੋਈ ਉਹਦਾ ਜੀ ਫੈਂਟ ਹੋਵੇਗਾ ਨਾ ਹੀ ਆਪਣੇ ਉਹਦਾ ਕੋਈ ਸੀਲਨ ਵਗੈਰਾ ਆਊਗੀ ਜੀ ਨਾ ਖਰਾਬ ਹੋਊਗਾ ਉਹਦੇ ਨਾਲ ਹਾਂਜੀ ਹਾਂਜੀ ਵਧੀਆ ਕੁਆਲਟੀ ਮਿਲੇਗੀ ਜੀ ਤੁਹਾਨੂੰ ਆਪਣੇ ਇੱਕ ਸਾਲ ਦੀ ਤਾਂ ਉਹਦੀ ਜੀ ਆਪਣੇ ਗਰੰਟੀ ਹੈ ਜੀ ਪੇਂਟ ਦੀ ਨਾ ਜੀ ਕੋਈ ਖਰਾਬ ਨਹੀਂ ਹੋਊਗਾ ਸੀਲਨ ਵਗੈਰਾ ਨਹੀਂ ਆਊਗੀ ਹਾਂਜੀ ਹਾਂਜੀ ਜੀ ਦੇ ਅ ਹਾਂਜੀ ਹਾਂਜੀ ਦੇਖੋ ਜੀ ਅੱਜ ਕੱਲ੍ਹ ਜਿਹੜਾ ਵਾਈਟ ਵਾਈਟ ਕਲਰ ਹੈ ਜੀ ਉਹ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਜੀ ਰੂਮਸ ਵਗੈਰਾ ਦੇ ਵਿੱਚ ਅਤੇ ਪੂਜਾ ਵਗੈਰਾ ਦੇ ਆਪਣੇ ਪੂਜਾ ਵਗੈਰਾ ਦੇ ਰੂਮ ਵਿੱਚ ਬਾਕੀ ਲੋਬੀ 'ਚ ਤਾਂ ਜੀ ਦੇਖੋ ਬਾਕੀ ਆਹ ਜਿਹੜੀ ਜੀ ਤੁਹਾਡੀ ਮਰਜ਼ੀ ਹੈ ਜੀ ਜਿਹੜਾ ਤੁਹਾਨੂੰ ਰੰਗ ਵਧੀਆ ਲੱਗਦਾ ਹੈ ਜੀ ਦੇਖੋ ਲੋਬੀ ਅਤੇ ਡਰਾਇੰਗ ਰੂਮ 'ਚ ਅੱਜ ਕੱਲ੍ਹ ਥੋੜ੍ਹਾ ਜਿਹਾ ਲਾਈਟ ਕਲਰ ਚੱਲ ਰਿਹਾ ਜੀ ਜਿਵੇਂ ਹਲਕੇ ਰੰਗ ਆਪਾਂ ਕਹਿ ਦੇਈਏ ਅਤੇ ਬਾਕੀ ਕੋਈ ਆਪਣੇ ਹੋਰ ਜੀ ਆਪਣੇ ਪੂਜਾ ਘਰ ਹੈ ਉਹ ਤੁਹਾਨੂੰ ਦੱਸਤਾ ਜੀ ਜੀ ਕਮਰੇ ਵਗੈਰਾ 'ਚ ਜੀ ਤੁਹਾਡੀ ਮਰਜ਼ੀ ਹੈ ਜੀ ਤੁਹਾਨੂੰ ਜਿਹੜਾ ਰੰਗ ਵਧੀਆ ਲੱਗਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਖਰਚਾ ਵਗੈਰਾ ਜੀ ਦੇਖੋ ਜੀ ਤੁਹਾਡੇ ਉਹ ਤਾਂ ਸੁਕੇਅਰ ਫੁੱਟ ਦੇ ਹਿਸਾਬ ਨਾਲ ਜੀ ਪੈਸੇ ਲੱਗਦੇ ਆਪਣੇ ਜੀ ਬਾਰ੍ਹਾਂ ਬਾਰ੍ਹਾਂ ਰੁਪਏ ਸੁਕੇਅਰ ਫੁੱਟ ਦੇ ਹਿਸਾਬ ਨਾਲ ਹੈ ਜੀ ਜੇ ਤੁਸੀਂ ਪੱਟੀ ਭਰਾਉਂਗੇ ਜੀ ਫੇਰ ਆਪਣੇ ਵੀਹ ਰੁਪਏ ਸੁਕੇਅਰ ਫੁੱਟ ਦੇ ਹਿਸਾਬ ਨਾਲ ਹੈ ਅਤੇ ਅਦਰ ਜੇ ਬਿਨਾ ਪੱਟੀ ਤੋਂ ਇਕੱਲਾ ਪੇਂਟ ਪੇਂਟ ਕਰਾਉਣਾ ਹੈ ਜੀ ਫੇਰ ਆਪਣੇ ਚੌਦ੍ਹਾਂ ਰੁਪਏ ਸੁਕੇਅਰ ਫੁੱਟ ਦੇ ਹਿਸਾਬ ਨਾਲ ਜੀ ਲੱਗਣਗੇ ਜੀ ਪੈਸੇ ਰੂਮ ਦੇ ਹਿਸਾਬ ਨਾਲ ਹੈ ਜੀ ਬਾਕੀ ਤੁਹਾਡੇ ਕਿੰਨਾ ਰੂਮ ਹੈ ਓਕੇ ਜੀ ਕੱਲ੍ਹ ਦੀ ਆਪਾਂ ਗੱਲ ਕਰ ਲੈਂਦੇ ਹਾਂ ਜੀ ਓਕੇ ਜੀ